ਹੈਲੋ ਹਾਂਜੀ ਆਪਣੇ ਸੁਨੀਲ ਟੂਰ ਐਂਡ ਟਰੈਵਲ ਤੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਸਰ ਜੀ ਮੈਂ ਨਾ ਜੀ ਤੁਹਾਡੇ ਟੂਰ ਐਂਡ ਟਰੈਵਲ ਦਾ ਬੜਾ ਨਾਮ ਸੁਣਿਆ ਅਤੇ ਮੈਂ ਬਾਹਰੋਂ ਆਇਆ ਸੀ ਅਤੇ ਹਾਂਜੀ ਮੈਂ ਰਾਜਸਥਾਨ ਤੋਂ ਆਇਆ ਜੀ ਅਤੇ ਮੈਂ ਸੁਣਿਆ ਜੀ ਇੱਥੇ ਆਪਣੇ ਪੰਜਾਬ ਦਾ ਜਿਵੇਂ ਹਿਸਟੋਰੀਕਲ ਪਲੇਸ ਜਿਵੇਂ ਹੋਲਾ ਮਹੱਲਾ ਹੋ ਗਿਆ ਫਿਰ ਤੁਸੀਂ ਸਾਨੂੰ ਟੂਰਿਸਟ ਕਰਾ ਸਕਦੇ ਹੋ ਤਾਂ ਫਿਰ ਹਾਂਜੀ ਅਸੀਂ ਅਸੀਂ ਜਾ ਅਸੀਂ ਚਾਰ ਜਣੇ ਹਾਂ ਜੀ

ਮਤਲਬ ਕੋਈ ਤੁਹਾਡੇ ਕੋਲ ਤੁਹਾਡੇ ਕੋਲ ਕੀ ਕੀ ਕੀ ਚੀਜ਼ਾਂ ਨੇ ਜੋ ਸਾਨੂੰ ਪ੍ਰੋਵਾਈਡ ਕਰ ਸਕਦੇ ਹੋ ਹਾਂਜੀ ਹਾਂਜੀ ਨਹੀਂ ਇੱਥੇ ਪਹੁੰਚਣ ਲਈ ਕੀ ਤੁਹਾਡੇ ਕੋਲ ਕੀ ਸੁਵਿਧਾਵਾਂ ਨੇ ਕਾਰ ਹਾਂਜੀ ਕਕ ਕੈਬ ਵਗੈਰਾ ਹਾਂਜੀ ਬਸ ਫਿਰ ਅਸੀਂ ਫੌਰ ਜਾਣੇ ਹਾਂ ਚਾਰ ਜਾਣੇ ਹਾਂ ਅਤੇ ਕੋਈ ਕੈਬ ਹਾਂ ਕੈਬ ਬੁੱਕ ਕਰਵਾ ਕੇ ਦੇ ਹਾਂਜੀ ਹਾਂਜੀ ਹੋਰ ਵੀ ਇਸ ਤੋਂ ਇਲਾਵਾ ਹੋਰ ਵੀ ਕੋਈ ਪਲੇਸਿਸ ਘੁੰਮਣ ਵਾਸਤੇ ਹਾਂਜੀ

ਹਾਂਜੀ ਚਲੋ ਠੀਕ ਹੈ ਜੀ ਫਿਰ ਠੀਕ ਹੈ ਜੀ